ਮੇਰਾ ਨਾਮ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਜੇਕਰ ਗੱਲ ਕਰੀਏ ਕਿ ਪੁਰਾਣੇ ਸਮੇਂ ਵਿੱਚ ਕੱਪੜੇ ਕਿਹੋ ਜਿਹੇ ਸਨ ਤਾਂ ਪੁਰਾਣੇ ਜੇ ਤਾਂ ਗੱਲ ਕਰੀਏ ਪੁਰਾ ਸਮੇਂ ਦੀ ਤਾਂ ਕੱਪੜੇ ਕਈ ਆਦੀਵਾਸੀ ਸਮੇਂ ਵਿੱਚ ਕੱਪੜੇ ਪੱਤਿਆਂ ਨਾਲ ਬਣਾਏ ਜਾਂਦੇ ਸਨ ਤਾਂ ਹੁਣ ਉਸ ਤੋਂ ਬਾਅਦ ਕੁਛ ਸਮੇਂ ਬਾਅਦ ਕੱਪੜੇ ਰੂੰ ਦੇ ਕੱਪੜੇ ਬਣਨ ਲੱਗੇ ਖਾਦੀ ਦੇ ਕੱਪੜੇ ਬਣਨ ਲੱਗੇ ਗਾਂਧੀ ਜੀ ਨੇ ਖਾਦੀ ਦੇ ਕੱਪੜਿਆਂ ਦਾ ਪ੍ਰੋਸਾਹਨ ਕੀਤਾ ਸੀ ਊਂ ਅੱਜ ਕੱਲ੍ਹ ਕਈ ਤਰ੍ਹਾਂ ਦੇ ਫੈਸ਼ਨ ਨੇਵਲ ਕੱਪੜੇ ਆਉਣ ਡਏ ਹਨ ਨ ਜਿੱਦਾਂ ਕਈਂ ਲੋਕ ਕੁੜਤੇ ਪਜਾਮੇ ਪਾਉਂਦੇ ਹਨ ਅਤੇ ਕਈਆਂ ਨੇ ਫਟ ਜੀਨਾਂ ਪਾਈ ਦੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਕੱਟ ਲੱਗੇ ਹੋਣ ਕਈ ਟੀ ਸ਼ਰਟਾਂ ਪਾਉਂਦੇ ਹਨ ਆਦਿ ਆਦਿ ਤਰ੍ਹਾਂ ਦੇ ਕੱਪੜੇ ਆ ਰਹੇ ਹਨ ਪਰ ਮੈਨੂੰ ਜ਼ਿਆਦਾਤਰ ਕੁੜਤੇ ਪਜਾਮਾ ਅਤੇ ਪੈਂਟ ਸ਼ਰਟ ਪਾਉਣ ਦਾ ਸ਼ੌਂਕ ਹੈ ਜੇਕਰ ਗੱਲ ਕਰੀਏ ਕਿ ਵੱਖ ਵੱਖ ਤਰ੍ਹਾਂ ਦੇ ਕੱਪੜੇ ਬਹੁਤ ਤਰ੍ਹਾਂ ਦੇ ਕੱਪੜੇ ਆਉਂਦੇ ਹਨ ਪਰ ਸਾਨੂੰ ਆਪਣੇ ਕਲਚਰ ਦੇ ਕੱਪੜੇ ਪਾਉਣੇ ਚਾਹੀਦੇ ਹਨ ਸਾਡੇ ਇੱਥੇ ਵੈਸਟਰਨ ਕ ਕਲਚਰ ਦੇ ਕੱਪੜੇ ਵੀ ਬਹੁਤ ਪੈਂਦੇ ਹਨ ਤਾਂ ਸਾਨੂੰ ਆਪਣੇ ਦੇਸ਼ ਵਿੱਚ ਆਪਣੇ ਕਲਚਰ ਦੇ ਕੱਪੜੇ ਪਾਉਣੇ ਚਾਹੀਦੇ ਹਨ ਸਾਨੂੰ ਬਾਹਰਲੇ ਦੇਸ਼ ਦੇ ਕਲਚਰ ਦੇ ਕੱਪੜਿਆਂ ਨੂੰ ਜ਼ਿਆਦਾ ਪ੍ਰੋਤਸਾਹਨ ਕਰਨ ਦੀ ਜਗਾ ਆਪਣੇ ਦੇਸ਼ ਦੇ ਕਲਚਰ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਵਾਧਾ ਦੇਣਾ ਚਾਹੀਦਾ ਹੈ